ਸਰਕਾਰੀ ਯੋਜਨਾਵਾਂ ਅਧੀਨ ਪ੍ਰਦਾਨ ਕੀਤੀਆਂ ਸਿਹਤ ਸੇਵਾਵਾਂ ਦੀ ਮਾਨਵੀ ਗੁਣਵੱਤ ਵਿੱਚ ਵਰਤਿਆ ਹੋ ਸਕਦੀਆਂ ਹੈ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਕੇਂਦਰਾਂ ਵਿੱਚ ਜਾਣ ਦੀ ਚੋਣ ਵਿਅਕਤੀ ਦੇ ਸੰਦਰਭ 'ਤੇ ਨਿਰਭਰ ਕਰਦੀ ਹੈ ਸਰਕਾਰੀ ਹਸਪਤਾਲਾਂ ਨੇ ਆਮ ਤੌਰ 'ਤੇ ਘਰੇਲੂ ਸੰਸਥਾ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਹਨ ਜਾਂ ਪ੍ਰਾਈਵੇਟ ਹਸਪਤਾਲਾਂ ਵਿੱਚ ਵਧੇਰੇ ਮੁਲਾਜ਼ਮ ਅਤੇ ਤਕਨੀਕੀ ਉਪਕਰਨ ਦੀ ਸੁਵਿਧਾ ਹੁੰਦੀ ਹੈ ਪਰ ਇਸ ਦੇ ਲਈ ਜ਼ਰੂਰੀ ਹੈ ਕਿ ਪ੍ਰਾਈਵੇਟ ਹਸਪਤਾਲਾਂ ਵਧੇਰੇ ਮੁਲਾਜ਼ਮ ਅਤੇ ਘੰਟਾ ਘੜੀ ਵੇਖਿਆ ਜਾਂਦਾ ਹੈ ਪਰ ਵਧੇਰੇ ਖਰਚੇ 'ਤੇ ਸਰਕਾਰੀ ਹਸਪਤਾਲ ਅਕਸਰ ਥੋੜ੍ਹੀ ਵਧੀਆ ਮਾਨਵੀ ਸੇਵਾ ਪ੍ਰਦਾਨ ਕਰਦੇ ਹਨ ਪਰ ਥੋੜ੍ਹੀ ਦੇਰ ਹੀ ਸੇਵਾ ਦੇ ਕਾਰਨ ਇਸ ਨੂੰ ਛੇਤੀ ਪਹੁੰਚ ਨਹੀਂ ਸਕਦੇ